ਪੰਜਾਬੀ ਭਾਸ਼ਾ ਜਿਹੜੀ ਕਿ ਪੰਜਾਬੀਆਂ ਦੀ ਮਾਤ ਭਾਸ਼ਾ ਹੈ ਅੱਜ ਕੱਲ੍ਹ ਲੋਕ ਇਸ ਤੋਂ ਪਿਛਾਂਹ ਹੁੰਦੇ ਜਾ ਰਹੇ ਹਨ ਕਿਉਂਕਿ ਸਕੂਲਾਂ ਕਾਲਜਾਂ ਵਿੱਚ ਜ਼ਿਆਦਾਤਰ ਪੰਜਾਬੀ ਨੂੰ ਛੱਡ ਕੇ ਅੰਗਰੇਜ਼ੀ ਅਤੇ ਹਿੰਦੀ ਵੱਲ ਬੱਚਿਆਂ ਦਾ ਧਿਆਨ ਜ਼ਿਆਦਾ ਵਧਾਇਆ ਜਾਂਦਾ ਹੈ ਅੱਜ ਕੱਲ੍ਹ ਬਹੁਤ ਸਾਰੇ ਬੱਚੇ ਜਿਹੜੇ ਕਿ ਅੰਗਰੇਜ਼ੀ ਭਾਸ਼ਾ ਨੂੰ ਜ਼ਿਆਦਾ ਵਧਾ ਦਿੰਦੇ ਹਨ ਕਿਉਂਕਿ ਅੱਜ ਕੱਲ੍ਹ ਬੱਚਿਆਂ ਵਿੱਚ ਬਹੁਤ ਹੀ ਜ਼ਿਆਦਾ ਬਾਹਰ ਜਾਣ ਦਾ ਜਿਹੜਾ ਕਿ ਉਹਨਾਂ ਦੇ ਦਿਮਾਗ ਵਿੱਚ ਆਇਆ ਹੈ ਅਤੇ ਉਹ ਅੰਗਰੇਜ਼ੀ ਭਾਸ਼ਾ ਨੂੰ ਜ਼ਿਆਦਾ ਸਿੱਖਦੇ ਹਨ ਅਤੇ ਅੱਜ ਕੱਲ੍ਹ ਦੇ ਬੱਚੇ ਜਿਹੜੇ ਆ ਉਹ ਹਿੰਦੀ ਭਾਸ਼ਾ ਵੱਲ ਵੀ ਜ਼ਿਆਦਾ ਧਿਆਨ ਦਿੰਦੇ ਹਨ ਜਿਹੜੇ ਕਿ ਬਹੁਤ ਹੀ ਬੁਰੀ ਗੱਲ ਹੈ ਕਿਉਂਕਿ ਜਿਹੜੇ ਆਪਣੀ ਪੰਜਾਬੀ ਭਾਸ਼ਾ ਹੈ ਲੋਕ ਉਹਨਾਂ ਨੂੰ ਭੁੱਲਦੇ ਜਾ ਰਹੇ ਹਨ ਅਤੇ ਜਿਹੜੀ ਆਪਣੀ ਪੰਜਾਬੀ ਭਾਸ਼ਾ ਅਤੇ ਹੋਰਨਾਂ ਸੱਭਿਆਚਾਰਾਂ ਵਿੱਚ ਜਾ ਕੇ ਜਿਹੜੀ ਪੰਜਾਬੀ ਕਲਚਰ ਨੂੰ ਆਪਾਂ ਭੁੱਲਦੇ ਜਾ ਰਹੇ ਹਾਂ ਜਿਹੜਾ ਆਪਣਾ ਪੰਜਾਬੀ ਕਲਚਰ ਆ ਇਹ ਬਹੁਤ ਹੀ ਵੱਡੀ ਵਿਰਾਸਤ ਹੈ ਅਤੇ ਇਹਨੂੰ ਆਪਾਂ ਪਿੱਛੇ ਨਹੀਂ ਛੱਡ ਸਕਦੇ ਜੇਕਰ ਆਪਾਂ ਹੋਰਨਾਂ ਭਾਸ਼ਾ ਵੱਲ ਵੀ ਧਿਆਨ ਦੇ ਰਹੇ ਹਾਂ ਕਿਸੇ ਕਿਸੇ ਕੰਮ ਕਰਕੇ ਤਾਂ ਆਪਾਂ ਨੂੰ ਜਿਹੜੀ ਪੰਜਾਬੀ ਭਾਸ਼ਾ ਹੈ ਉਹਨੂੰ ਵੀ ਅੱਗੇ ਲੈ ਕੇ ਹੀ ਜਾਣਾ ਚਾਹੀਦਾ ਹੈ ਕਿਉਂਕਿ ਉਹ ਆਪਣੀ ਮਾਤ ਭਾਸ਼ਾ ਹੈ ਅਤੇ ਉਹ ਵੀ ਅੱਗੇ ਜਾ ਕੇ ਬਹੁਤ ਹੀ ਕੰਮ ਆਉਣੀ ਹੈ